ਭਾਰਤ ਵਿੱਚ ਡਾਂਸਰਸ ਦਾ ਬੜਾ ਪ੍ਰਭਾਵ ਹੋ ਰਿਹਾ ਹੈ ਅੱਜ ਕੱਲ੍ਹ ਲੋਕ ਗਾਣੇ ਬਹੁਤ ਸੁਣਦੇ ਨੇ ਹਾਂਜੀ ਨੱਚਦੇ ਟੱਪਦੇ ਆ ਬੱਚੇ ਵੀ ਬੁੱਢੇ ਵੀ ਸਭ ਬੜੇ ਅਲੱਗ ਅਲੱਗ ਤਰ੍ਹਾਂ ਦੇ ਗੀਤ ਪਸੰਦ ਕਰਦੇ ਹੈ ਹਾਂਜੀ ਪੰਜਾਬੀ ਗੀਤ 'ਤੇ ਨਾਚ ਬਹੁਤ ਹੋ ਰਿਹਾ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਬੜਾ ਡਾਂਸ ਹੋ ਰਿਹਾ ਭੰਗੜਾ ਦੇਖ ਦੇਖ ਕੇ ਲੋਕ ਬਹੁਤ ਖੁਸ਼ ਹੁੰਦੇ ਹੈ ਹਾਂਜੀ ਬਹੁਤ ਮਸ਼ਹੂਰ ਹੋ ਗਿਆ ਜੀ ਹਾਂਜੀ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਭੰਗੜਾ ਵੀ ਪਾਉਂਦੇ ਹੈ ਗਾਣੇ ਵੀ ਸੁਣਦੇ ਹੈ ਬਹੁਤ ਅਨੰ ਪੰਜਾਬੀ ਗਾਣੇ ਗਾ ਬਹੁਤ ਸੁਣਦੇ ਨੇ ਬੜਾ ਉਹਨਾਂ ਨੂੰ ਆਨੰਦ ਆਉਂਦਾ ਹੈ ਹਾਂਜੀ ਬੋਲੀਵੁੱਡ ਦੇ ਵਿੱਚ ਵੀ ਅੱਜ ਪੰਜਾਬੀ ਗਾਣੇ ਬੋਲਦੇ ਨੇ ਸੁਣਦੇ ਨੇ ਬੜਾ ਆਨੰਦ ਮਾਣਦੇ ਨੇ ਉੱਥੇ ਹਾਂਜੀ ਬਾਕੀ ਗਾਣੇ ਵੀ ਤੁਹਾਡੇ ਸਾਰੇ ਪਸੰਦ ਆਉਂਦੇ ਨੇ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ